ਬਹੁਤ ਸਾਰੇ ਕਸਰਤਾਂ ਹਨ ਜੋ ਕਿ ਲਿੰਗ ਅਤੇ ਉਮਰ ਦੀ ਪਰਵਾਹ ਕੀਤੇ ਬਿਨਾਂ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਰੋਜ਼ ਸਵੇਰੇ ਸੈਰ ਕਰਨਾ ਦੌੜਨਾ ਯੋਗਾ ਕਰਨਾ ਇਹ ਸ਼ਾਮਿਲ ਹਨ ਇਹਨਾਂ ਵਿ ਇਹਨਾਂ ਲਈ ਕਿਸੇ ਵੀ ਉਮਰ ਹੱਦ ਦੀ ਜਾਂ ਫਿਰ ਲਿੰਗ ਦੀ ਲਿੰਗ ਦਾ ਅੰਤਰ ਨਹੀਂ ਕੀਤਾ ਜਾਂਦਾ ਕਿਸੇ ਵੀ ਉਮਰ ਦਾ ਜਾਂ ਫਿਰ ਕੋਈ ਵੀ ਲਿੰਗ ਵਾਲਾ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਸਵੇਰੇ ਸੈਰ ਕਰ ਸਕਦਾ ਹੈ ਇਸ ਨਾਲ ਉਸ ਸਰੀਰ ਵਿੱਚ ਫੁਰਤੀ ਆਉਂਦੀ ਹੈ ਅਤੇ ਸਵੇਰੇ ਸਵਾ ਬਹੁਤ ਤਾਜ਼ੀ ਹੁੰਦੀ ਹੈ ਜਿਸ ਨਾਲ ਸਰੀਰ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ਸਵੇਰ ਦੀ ਸੈਰ ਕਰਨ ਹਰ ਇੱਕ ਲਈ ਬਹੁਤ ਜ਼ਰੂਰੀ ਹੈ ਹਰ ਇੱਕ ਲਈ ਬਹੁਤ ਜ਼ਰੂਰੀ ਹੈ ਇਸ ਨਾਲ ਵਿਅਕਤੀ ਵਿੱਚ ਤਾਜ਼ਾਪਣ ਆਉਂਦਾ ਹੈ ਉਸਨੂੰ ਪੋਜੀਟਿਵ ਐਨਰਜੀ ਮਿਲਦੀ ਹੈ ਇਸ ਦੇ ਨਾਲ ਨਾਲ ਯੋਗਾ ਕਰਨਾ ਵੀ ਹਰੇਕ ਵਿਅਕਤੀ ਨੂੰ ਹਰੇਕ ਵਿਅਕਤੀ ਲਈ ਜ਼ਰੂਰੀ ਹੈ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸ਼ਰ ਹੱਡੀਆਂ ਮਜ਼ਬੂਤ ਹੁੰਦੇ ਹਨ ਲਚਕਦਾਰ ਹੁੰਦੀਆਂ ਲਚਕਦਾਰ ਵੀ ਹੁੰਦੀਆਂ ਹਨ ਕਸਰਤਾਂ ਕਸਰਤ ਕਰਨ ਨਾਲ ਸ਼ਰੀਰ ਸ ਸਵੱਸਥ ਅਤੇ ਤੰਦਰੁਸਤ ਰਹਿੰਦਾ ਹੈ ਸਰੀਰ ਸਵੱਸਥ ਅਤੇ ਤੰਦਰੁਸਤ ਰਹਿੰਦਾ ਹੈ ਬਹੁਤ ਸਾਰੇ ਮੁੰਡੇ ਕੁੜੀਆਂ ਅਜਿਹੇ ਹਨ ਜੋ ਜਿੰਮ ਵੀ ਲਾਉਂਦੇ ਹਨ ਜਿਸ ਨਾਲ ਜਿਸ ਨਾਲ ਉਹਨਾਂ ਦਾ ਸਰੀਰ ਫਿਟ ਰਹਿੰਦਾ ਹੈ ਜਿਸ ਨਾਲ ਉਹਨਾਂ ਦਾ ਸਰੀਰ ਫਿਟ ਰਹਿ ਫਿੱਟ ਰਹਿੰਦਾ ਹੈ ਬਹੁਤ ਸਾਰੇ ਬਹੁਤ ਸਾਰੇ ਕੁੜੀਆਂ ਮੁੰਡੇ ਆਪਣਾ ਭਾਰ ਘਟਾਉਣ ਘਟਾਉਣ ਲਈ ਜੋ ਕਿ ਜ਼ਿਆਦਾ ਮੋਟੇ ਹੁੰਦੇ ਹਨ ਉਹ ਆਪਣਾ ਭਾਰ ਉਹ ਆਪਣਾ ਭਾਰ ਘਟਾਉਣ ਲਈ ਤੇਜ਼ ਰਫਤਾਰ ਨਾਲ ਦੌੜਦੇ ਹਨ ਅਤੇ ਰਫਤਾਰ ਨਾਲ ਦੌੜਦੇ ਹਨ ਜਿੰਮ ਲਾਉਂ ਜਿੰਮ ਲਾਉਂਦੇ ਹਨ ਜਿਸ ਨਾਲ ਉਹਨਾਂ ਉਹਨਾਂ ਦਾ ਬੋਡੀ ਫੈਟ ਘੱਟ ਜਾਂਦਾ ਹੈ ਅਤੇ ਸੁਣਾ ਦਾ ਬੋਡੀ ਫੈਟ ਘੱਟ ਜਾਂਦਾ ਹੈ ਅਤੇ ਉਹ ਫਿੱਟ ਹੋ ਜਾਂਦੇ ਹਨ ਕਸਰਤਾਂ ਕਰਨੀਆਂ ਹਰੇਕ ਲਈ ਜ਼ਰੂਰੀ ਹਨ ਜੋ ਵਿਅਕਤੀ ਸਾ ਜੋ ਵਿਅਕਤੀ ਆਪਣੀ ਮ ਇਹ ਮੰਨਿਆ ਜਾਂਦਾ ਕਿ ਆਪਣੀ ਉਮਰ ਵਧਾਉਣ ਲਈ ਕਸਰਤ ਕਰਨਾ ਅਤੇ ਸਵੇਰ ਦੀ ਸੈਰ ਕਰਨਾ ਬਹੁਤ ਜ਼ਰੂਰੀ ਹੈ ਸਵੇਰ ਦੀ ਸੈਰ ਕਰਨ ਨਾਲ ਸਰੀਰ ਹਮੇਸ਼ਾ ਸਵੱਸਥ ਰਹਿੰਦਾ ਹੈ